ਸਾਡੇ ਪੰਜਾਬ ਵਿੱਚ ਬਹੁਤ ਸਾਰੀਆਂ ਸਰਕਾਰੀ ਜੋ ਸਕੀਮਾਂ ਚੱਲਦੀਆਂ ਹਨ ਜਿਨ੍ਹਾਂ ਜਿਨ੍ਹਾਂ ਵਿੱਚੋਂ ਕੁਛ ਮੈਂ ਸਕੀਮਾਂ ਬਾਰੇ ਜਾਣਦੀ ਹਾਂ ਉਹਨਾਂ ਵਿੱਚੋਂ ਕੁਛ ਨੇ ਜਿਵੇਂ ਕਿ ਸ ਸ਼ਗਨ ਸਕੀਮ ਸ਼ਗਨ ਸਕੀਮ ਦੇ ਵਿੱਚ ਜਿਵੇਂ ਕਿ ਅਗਰ ਕਿਸੇ ਲੜਕੀ ਦਾ ਮੈਰਿਜ਼ ਹੋ ਰਹੀ ਹੈ ਅਤੇ ਉਸ ਤੋਂ ਪਹਿਲਾਂ ਇੱਕ ਫਾਈਲ ਭਰੀ ਜਾਂਦੀ ਹੈ ਸ਼ਗਨ ਸਕੀਮ ਦੇ ਤੌਰ 'ਤੇ ਜੋ ਕਿ ਵਿਆਹ ਦੇ ਵਿਆਹ ਤੋਂ ਕੁਛ ਦਿਨ ਪਹਿਲਾਂ ਕੁੜੀ ਨੂੰ ਸਰਕਾਰ ਵੱਲੋਂ ਕੁਛ ਪੈਸੇ ਦਿੱਤੇ ਜਾਂਦੇ ਹਨ ਜੋ ਕਿ ਕੁੜੀ ਦੇ ਪਰਿਵਾਰ ਵਾਲੇ ਲੜਕੀ ਦੀ ਵਿਆਹ ਵਿੱਚ ਉਹ ਵਰਤ ਸਕਣ ਅਤੇ ਇਸੇ ਤਰ੍ਹਾਂ ਕਿ ਇੱਕ ਜਦੋਂ ਬੱਚਾ ਜਨਮ ਦਾ ਹੈ ਅਤੇ ਉਸ ਸਮੇਂ ਵੀ ਇੱਕ ਸ ਸਕੀਮ ਹੁੰਦੀ ਹੈ ਸ਼ਗਨ ਸਕੀਮ ਅਤੇ ਉਸ ਸਮੇਂ ਵੀ ਬੱਚੇ ਦੇ ਪੈਦਾ ਹੋਣ 'ਤੇ ਵੀ ਸਰਕਾਰ ਵੱਲੋਂ ਜੋ ਬੱਚੇ ਦੇ ਪੈ ਪੈਰੈਂਟਸ ਨੇ ਮਾਤਾ ਪਿਤਾ ਨੇ ਉਹਨਾਂ ਨੂੰ ਉਹ ਸ਼ਗਨ ਦੇ ਤੌਰ 'ਤੇ ਪੈਸੇ ਦਿੱਤੇ ਜਾਂਦੇ ਹਨ ਜਿਸ ਨਾਲ ਕਿ ਮਾਤਾ ਪਿਤਾ ਉਹਨਾਂ ਪੈਸਿਆਂ ਨਾਲ ਆਪਣੇ ਬੱਚੇ ਦੀ ਚੰਗੀ ਦੇਖਭਾਲ ਕਰ ਸਕਣ ਇਸ ਤੋਂ ਇਲਾਵਾ ਹੋਰ ਵੀ ਸਕੀਮਾਂ ਨੇ ਜਿਵੇਂ ਬੁਢਾਪਾ ਪੈਨਸ਼ਨ ਕਿ ਜੋ ਸੱਠ ਸਾਲ ਦੇ ਉੱਪਰ ਦੇ ਜੋ ਨੇ ਲੋਕ ਨੇ ਬੁੱਢੇ ਹੋ ਚੁੱਕੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਗੁਜ਼ਾਰਾ ਅੱਛੇ ਨਾਲ ਅੱਛੇ ਨਾਲ ਕਰ ਸਕਣ ਜਾਂ ਜਦੋਂ ਵੀ ਉਹਨਾਂ ਨੂੰ ਪੈਸਿਆਂ ਦੀ ਲੋੜ ਹੋਵੇ ਤਾਂ ਉਹ ਆਪਣੇ ਪੈਸੇ ਯੂਜ ਕਰ ਸਕਣ ਇੰਨੇ ਇਹਨਾਂ ਪੈਨਸ਼ਨ ਦੇ ਦੁਆਰਾ ਅਤੇ ਹੋਰ ਵੀ ਸਕੀਮਾਂ ਨੇ ਜਿਵੇਂ ਕਿ ਅਟਲ ਪੈਨਸ਼ਨ ਯੋਜਨਾ ਇਸ ਵਿੱਚ ਜੋ ਹੈ ਏਜ਼ ਦਾ ਕੇਡੇਗਿਰਿਆ ਉਹ ਅਠਾਰ੍ਹਾਂ ਤੋਂ ਚਾਲ੍ਹੀ ਸਾਲ ਦਾ ਹੁੰਦਾ ਹੈ ਹੋਰ ਵੀ ਜਿਵੇਂ ਲਾਡਲੀ ਲਕਸ਼ਮੀ ਯੋਜਨਾ ਜਾਂ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਜਿਸ ਵਿੱਚ ਕਿ ਲੜਕੀਆਂ ਦੇ ਜੋ ਉਜਵਲ ਭਵਿੱਖ ਲਈ ਇਹ ਯੋਜਨਾ ਚਲਾਈ ਜਾਂਦੀ ਹੈ ਕਿ ਕੁੜੀਆਂ ਜੋ ਹੈ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਆਪਣਾ ਜੋ ਗੁਜ਼ਾਰਾ ਕਰਨ ਲਈ ਜੋ ਹੈ ਉਹ ਖੁਦ ਤੋਂ ਚਲਾ ਸਕਣ ਉਹ ਕਿਸੇ ਦੇ ਉੱਪਰ ਵੀ ਡਿਪੈਂਡ ਨਾ ਰਹਿਣ ਇਸੇ ਤਰ੍ਹਾਂ ਇਹ ਸਕੀਮਾਂ ਦਾ ਲਾਭ ਲੈਣ ਲਈ ਸਾਨੂੰ ਪਹਿਲਾਂ ਤਾਂ ਐਲੀਜੀਬਿਲਟੀ ਚੈੱਕ ਕਰਨੀ ਪੈਂਦੀ ਹੈ ਕਿ ਅਸੀਂ ਕਿਸ ਸਕੀਮ ਲਈ ਜੋ ਹੈ ਅਸੀਂ ਐਲੀਜੀਬਲ ਹਾਂ ਕਿਸ ਸਕੀਮ ਲਈ ਅਸੀਂ ਆਪਣੀ ਫਾਈਲ ਭਰ ਸਕਦੇ ਹਾਂ ਜੋ ਵੀ ਉਹਨਾਂ ਨੇ ਜੋ ਕੁਛ ਲਿਮਿਟਸ ਰੱਖੀਆਂ ਹੁੰਦੀਆਂ ਰੂਲਸ ਰੱਖੇ ਹਨ ਉਹ ਚੈੱਕ ਕਰਨੇ ਪੈਂਦੇ ਹਨ ਕਿ ਅਸੀਂ ਉਸ ਏਜ਼ ਦੇ ਵਿੱਚ ਹਾਂ ਜਾਂ ਨਹੀਂ ਅਸੀਂ ਇੰਡੀਅਨ ਹਾਂ ਜਾਂ ਨਹੀਂ ਮਤਲਬ ਭਾਰਤ ਦੇ ਰਹਿਣ ਵਾਲੇ ਹਾਂ ਜਾਂ ਨਹੀਂ ਇਸ ਤਰੀਕੇ ਦੇ ਕੁਛ ਜੋ ਰੂਲਸ ਨੇ ਉਹ ਫੋਲੋ ਕਰਨੇ ਪੈਂਦੇ ਨੇ ਇਸ ਤੋਂ ਬਾਅਦ ਸਾਨੂੰ ਉਹਨਾਂ ਸਕੀਮ ਦੇ ਲਈ ਫਾਈਲ ਭਰਨੀ ਪੈਂਦੀ ਹੈ ਜੋ ਕਿ ਅਸੀਂ ਔਨਲਾਈਨ ਵੀ ਫਿਲ ਕਰ ਸਕਦੇ ਹਾਂ ਜੋ ਸਰਕਾਰ ਜਾਂ ਫਿਰ ਸਰਕਾਰੀ ਸੈਂਟਰ ਜੋ ਖੁੱਲ੍ਹੇ ਹੋਏ ਹਨ ਇਹਨਾਂ ਫਾਰਮਾਂ ਦੇ ਲਈ ਉੱਥੇ ਜਾ ਕੇ ਵੀ ਇਹ ਫਾਰਮ ਆਪਾਂ ਭਰ ਸਕਦੇ ਹਾਂ ਅਤੇ ਇਸ ਤੋਂ ਬਾਅਦ ਜੋ ਹੈ ਕਿ ਜੋ ਹਮ ਸਾਡੀ ਐਪਲੀਕੇਸ਼ਨ ਹੈ ਉਹ ਅਪਰੂਵ ਹੋਣ ਤੋਂ ਬਾਅਦ ਸਾਨੂੰ ਇਸ ਸਕੀਮ ਦਾ ਜੋ ਹੈ ਵੋ ਲਾਭ ਮਿਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਵੇਂ ਅੱਜ ਕੱਲ੍ਹ ਸਰਕਾਰ ਨੇ ਇੱਕ ਹੋਰ ਵੀ ਸ਼ੁਰੂ ਕਰ ਦਿੱਤਾ ਹੈ ਕਿ ਜੋ ਫਾਈਲ ਭਰਨ ਵਾਲੇ ਨੇ ਉਹ ਸਾਡੇ ਘਰ ਆ ਕੇ ਹੀ ਸਾਡੇ ਤੋਂ ਸਾਰੇ ਜੋ ਪ੍ਰੀਫ ਪਰੂਫ ਜੋ ਜੋ ਸਾਨੂੰ ਚਾਹੀਦੇ ਹਨ ਉਹ ਲਗਾ ਕੇ ਅਤੇ ਫਾਈਲ ਖੁਦ ਘਰ ਬਣਾ ਕੇ ਦੇ ਕੇ ਜਾਂਦੇ ਹਨ ਥੈਂਕ ਯੂ